ਇੱਕੀ ਦਸੰਬਰ ਉੱਨੀ ਸੌ ਚੁਰਾਸੀ ਤੀਹ ਜੂਨ ਉੱਨੀ ਸੌ ਨੱਬੇ ਇਕੱਤੀ ਮਈ ਦੋ ਹਜ਼ਾਰ ਪੰਜ ਪੰਜ ਸਤੰਬਰ ਉੱਨੀ ਸੌ ਪੰਜਾਹ ਛੱਬੀ ਜਨਵਰੀ ਉੱਨੀ ਸੌ ਪੈਂਤੀ